ਹਾਂਜੀ ਪ੍ਰਿਤਪਾਲ ਸਿੰਘ ਬੋਲਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਜੀ ਇੱਕ ਮੇਰਾ ਹੈਗਾ ਯੂਟਿਊਬ 'ਤੇ ਚੈਨਲ 'ਤੇ ਚੈਨਲ ਹੈ ਮੇਰਾ ਯੂਟਿਊਬ 'ਤੇ ਜੀ ਤੁਹਾਡਾ ਫਤਿਹਗੜ੍ਹ ਸਾਹਿਬ ਲੋਕਲ ਹੈ ਜੀ ਮੈਂ ਇਹਦੇ ਬਾਰੇ ਪੁੱਛਣਾ ਚਾਹੁੰਦਾ ਸਾਨੂੰ ਇਹਦੇ ਬਾਰੇ ਇਤਿਹਾਸ ਬਾਰੇ ਦੱਸ ਸਕਦੇ ਹੋ ਤਾਂ ਕਿ ਮੈਂ ਆਪਣੇ ਚੈਨਲ ਦੇ ਇਤਿਹਾਸ ਬਾਰੇ ਜਾਣਕਾਰੀ ਦੇ ਸਕਾਂ ਜੀ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ

ਠੀਕ ਹੈ ਜੀ

ਹਾਂਜੀ ਹਾਂਜੀ

ਠੀਕ ਹੈ ਜੀ ਠੀਕ ਹੈ ਠੀਕ ਹੈ ਚਲੋ ਜੀ ਫਿਰ ਅਸੀਂ ਪਰਸੋਂ ਨੂੰ ਆਉਣੇ ਮੈਂ ਫਿਰ ਆ ਕੇ ਸਾਡੇ ਸਾਨੂੰ ਇਹਦੇ ਬਾਰੇ ਵੀਡੀਓ ਬਣਾਉਣੀ ਆ ਸਾਡੇ ਨਾਲ ਤੁਸੀਂ ਸਾਨੂੰ ਇਤਿਹਾਸ ਦੀ ਜਾਣਕਾਰੀ ਦੇ ਦਿਓ ਜੀ ਠੀਕ ਠੀਕ ਹਾਂ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ